ਰਾਜ ਅਤੇ ਹੋਰ ਜਗ੍ਹਾ 'ਤੇ ਜਦੋਂ ਕੋਈ ਸੈਲਾਨੀ ਘੁੰਮਣ ਆਉਂਦੇ ਹਨ ਤਾਂ ਉਹ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ ਮਸ਼ਹੂਰ ਜਗ੍ਹਾ ਹਨ ਜਿਵੇਂ ਕਿ ਅੰਮ੍ਰਿਤਸਰ ਦਾ ਮੰਦਿਰ ਆਗਰਾ ਆਗਰੇ ਦਾ ਕਿਲ੍ਹਾ ਆ